ਹਾਂਜੀ ਵੈਸੇ ਤਾਂ ਮੈਂ ਆਨਲਾਈਨ ਸ਼ਾਪਿੰਗ ਕਰਦੀ ਰਹਿਨੀ ਆ ਪਰ ਪਿਛਲੇ ਹਫਤੇ ਮੈਂ ਵੀਵੋ ਫੋਨ ਦੇ ਵਾਈਟ ਕਲਰ ਦੇ ਹੈਡਫੋਨ ਮੰਗਵਾਏ ਸੀ ਜਿਹੜੇ ਕਿ ਵਾਇਰਲੈਸ ਸੀਗੇ ਤੇ ਵਾਟਰਪ੍ਰੂਫ ਵੀ ਆ ਇਹਨਾਂ ਦੀ ਵੋਲਮ ਕਪੈਸਿਟੀ ਜਿਹੜੀ ਆ ਇਹ ਬਹੁਤ ਹੀ ਜਿਆਦਾ ਵਧੀਆ ਇਹ ਕਿਸੇ ਵੀ ਚੀਜ਼ ਨੂੰ ਐਕਸਟਰਾ ਕਵਰ ਨਹੀਂ ਕਰਦੇ ਤੇ ਨਾ ਹੀ ਇਹਦੇ ਵਿੱਚ ਕੋਈ ਵੱਧ ਸ਼ੋਰ ਸ਼ਰਾਬਾ ਹੁੰਦਾ ਹੈ ਤੇ ਇਸ ਦੇ ਵਿੱਚ ਜਿਹੜੀ ਆਵਾਜ਼ ਆ ਉਹ ਬਹੁਤ ਹੀ ਕਲੀਅਰ ਆਉਂਦੀ ਆ ਮੈਨੂੰ ਇਹ ਬਹੁਤ ਜਿਆਦਾ ਵਧੀਆ ਲੱਗੇ ਤੇ ਮੈਂ ਇਹ ਸੋਚ ਰਹੀ ਆਂ ਕਿ ਮੈਂ ਇਹਨਾਂ ਦੇ ਨਾਲ ਦੇ ਦੋ ਹੋਰ ਹੈਡਫੋਨ ਮੰਗਵਾਵਾਂ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਦਵਾਂ ਕਿਉਂਕਿ ਮੈਨੂੰ ਇਹ ਬਹੁਤ ਜਿਆਦਾ ਪਸੰਦ ਆਏ ਆ ਇਹਨਾਂ ਦੀ ਕੁਆਲਿਟੀ ਆ ਜਿਹੜੀ ਉਹ ਮੈਨੂੰ ਬਹੁਤ ਹੀ ਜਿਆਦਾ ਵਧੀਆ ਲੱਗੀ ਆ ਤੇ ਇਹਨਾਂ ਦਾ ਕਲਰ ਬਹੁਤ ਪਿਆਰਾ ਤੇ ਮੈਂ ਇੱਛਾ ਕਰਦੀ ਆਂ ਕਿ ਤੁਸੀਂ ਮੈਨੂੰ ਜਿਹੜੇ ਮੈਂ ਹੁਣ ਫਿਰ ਦੋ ਹੈਡਫੋਨ ਹੋਰ ਮੰਗਵਾਵਾਂਗੀ ਉਹ ਵੀ ਇਸੇ ਤਰ੍ਹਾਂ ਬੈਸਟ ਕੁਆਲਿਟੀ ਦੇ ਹੀ ਮੈਨੂੰ ਭੇਜੋਗੇ ਧੰਨਵਾਦ